ਟੈਕਨੋਲੋਜੀ ਕਾਰਨ ਬਿਰਧ ਅਤੇ ਦ੍ਰਿਸ਼ਟੀਹੀਣਾਂ ਨੂੰ ਬਹੁਤ ਮਦਦ ਕੀਤੀ ਹੈ ਬਿਰਧਾਂ ਅਤੇ ਦ੍ਰਿਸ਼ਟੀਹੀਣਾਂ ਨੂੰ ਬੋਲ ਕੇ ਯੂਟਿਊਬ ਜਾਂ ਯੂਟਿਊਬ ਦੁਆਰਾ ਕੁਝ ਵੀ ਸੁਣ ਸਕਦੇ ਹਨ